ਭੰਗੜਾ ਪੰਜਾਬ ਦਾ ਇੱਕ ਪ੍ਰਸਿੱਧ ਨਾਚ ਹੈ ਇਹ ਸਾਡੀ ਸਿਹਤ ਲਈ ਬਹੁਤ ਵਧੀਆ ਸਾਬਿਤ ਹੁੰਦਾ ਹੈ ਇਹਦੇ ਫ਼ਾਇਦੇ ਸਾਡੇ ਤਨ ਅਤੇ ਮਨ ਦੋਨਾਂ 'ਤੇ ਨਜ਼ਰ ਆਉਂਦੇ ਹਨ ਜਿਵੇਂ ਸਾਡਾ ਸ ਤਨ ਸਵਸਥ ਹੁੰਦਾ ਹੈ ਅਤੇ ਮਨ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਜੇ ਸਵੇਰੇ ਰੋਜ਼ ਅਸੀਂ ਦਸ ਜਾਂ ਵੀਹ ਮਿੰਟ ਲਈ ਭੰਗੜਾ ਕਰਦੇ ਹਾਂ ਅਤੇ ਇਹ ਸਾਡੇ ਲਈ ਕਾਰਡੀਓ ਦਾ ਕੰਮ ਕਰਦਾ ਹੈ ਕਾਰਡੀਓ ਜਿਮ ਅਤੇ ਫਿਟਨੈਸ 'ਚ ਕਰਵਾਈ ਜਾਣ ਵਾਲੀ ਇੱਕ ਇੰਟੈਂਸ ਐਕਸਰਸਾਈਜ਼ ਹੈ ਜਿਹਦੇ ਸਾਨੂੰ ਬੜੇ ਫ਼ਾਇਦੇ ਦੇਖਣ ਨੂੰ ਮਿਲਦੇ ਹਨ ਜੇ ਭੰਗੜਾ ਅਸੀਂ ਰੋਜ਼ ਸਵੇਰੇ ਕਰਦੇ ਹਾਂ ਤਾਂ ਸਾਨੂੰ ਕਾਰਡੀਓ ਵਰਗੇ ਫ਼ਾਇਦੇ ਮਿਲਦੇ ਹਨ ਜਿੱਦਾਂ ਕਿ ਸਾਡਾ ਭਾਰ ਘੱਟਦਾ ਹੈ ਸਾਨੂੰ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਸਾਡਾ ਸਰੀਰ ਬਹੁਤ ਮਜਬੂਤ ਹੁੰਦਾ ਹੈ ਅਤੇ ਜਿਹੜਾ ਸਭ ਤੋਂ ਵੱਡਾ ਫ਼ਾਇਦਾ ਇਹਦਾ ਹੈ ਉਹ ਇਹ ਹੈ ਕਿ ਸਾਡਾ ਸਟਰੈਸ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਸਾਡੇ ਦਿਮਾਗ 'ਤੇ ਜਿਹੜੀ ਟੈਨਸ਼ਨ ਹੁੰਦੀ ਹੈ ਉਹ ਲੱਥ ਜਾਂਦੀ ਹੈ ਅਤੇ ਅਸੀਂ ਸਵੱਸਥ ਮਹਿਸੂਸ ਕਰਦੇ ਹਾਂ ਸਾਰਾ ਦਿਨ ਅਤੇ ਜੇ ਅਸੀਂ ਰਿਵਾਇਤੀ ਪੰਜਾਬੀ ਸੰਗੀਤ ਭੰਗੜੇ ਦੇ ਨਾਲ ਜੋੜ ਦੇਈਏ ਇਹ ਇੱਕ ਬਹੁਤ ਦਿਲਚਸਪ ਐਕਟੀਵਿਟੀ ਬਣਦੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬੀ ਗੀਤ ਜਿਹੜੇ ਹਨ ਉਹ ਬਹੁਤ ਪ੍ਰਸਿੱਧ ਹਨ ਅਤੇ ਸਾਰਿਆਂ ਦੁਆਰਾ ਬਹੁਤ ਪਸੰਦ ਕੀਤੇ ਜਾਂਦੇ ਹਨ ਜੇ ਅਸੀਂ ਪੰਜਾਬੀ ਗੀਤ ਲਗਾ ਕੇ ਭੰਗੜਾ ਕਰਦੇ ਹਾਂ ਤਾਂ ਇਹਦੇ 'ਤੇ ਹੋਰ ਚਾਰ ਚੰਦ ਲੱਗ ਜਾਂਦੇ ਹਨ ਅਤੇ ਇਹ ਬਹੁਤ ਦਿਲਚਸਪ ਬਣ ਜਾਂਦਾ ਹੈ ਇਹ ਦਿਲਚਸਪ ਵੀ ਬਣ ਜਾਂਦਾ ਹੈ ਅਤੇ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਸਵੇਰੇ ਰੋਜ਼ ਦਸ ਜਾਂ ਵੀਹ ਮਿੰਟ ਲਈ ਭੰਗੜਾ ਕਰੀਏ ਅਤੇ ਅਸੀਂ ਸਾਰਾ ਦਿਨ ਫਰੈਸ਼ ਅਤੇ ਸਵੱਸਥ ਫੀਲ ਕਰਿਆ ਕਰਾਂਗੇ